ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਜਿਸ ਦੇ ਅੰਦਰ ਕਾਫੀ ਕੁਝ ਆ ਜਾਂਦਾ ਹੈ ਇਸ ਦੇ ਅੰਦਰ ਮੁੱਖ ਸਥਾਨ ਤਾਂ ਬਹੁਤ ਸਾਰੇ ਨੇ ਪਰ ਕੁਛ ਸਥਾਨ ਇਹੋ ਜਿਹੇ ਹਨ ਜਿਹਨਾਂ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਹੈ ਇਸ ਦੇ ਵਿੱਚ ਕੁਛ ਸਥਾਨ ਦਿੱਲੀ ਦੇ ਵਿੱਚ ਸਥਿਤ ਹਨ ਦਿੱਲੀ ਇੱਕ ਬਹੁਤ ਵੱਡਾ ਸ਼ਹਿਰ ਹੈ ਜਿਸ ਦੇ ਅੰਦਰ ਕੁਤੁਬ ਮੀਨਾਰ ਲਾਲ ਕਿਲ੍ਹਾ ਅਤੇ ਬਹੁਤ ਸਾਰੇ ਅਲੱਗ ਅਲੱਗ ਜਗ੍ਹਾ ਹਨ ਜਿਸ ਜਿਸ ਦੇ ਵਿੱਚ ਘੁੰਮਣ ਦਾ ਅਲੱਗ ਹੀ ਮਜ਼ਾ ਹੈ ਇੱਥੇ ਕਾਫੀ ਸਾਰੇ ਮੰਦਰ ਅਤੇ ਗੁਰਦੁਆਰੇ ਹਨ ਜਿਸ ਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਮੱਥਾ ਟੇਕਣ ਅਤੇ ਘੁੰਮਣ ਲਈ ਆਉਂਦੇ ਹਨ ਇਸ ਤੋਂ ਇਲਾਵਾ ਜੇ ਅਸੀਂ ਪਹਾੜਾਂ ਦੀ ਗੱਲ ਕਰੀਏ ਤਾਂ ਹਿਮਾਚਲ ਅਤੇ ਉੱਤਰਾਖੰਡ ਪ੍ਰਸਿੱਧ ਖੇਤਰ ਹਨ ਜਿਸ ਦੇ ਵਿੱਚ ਸੈਲਾਨੀਆਂ ਨੂੰ ਮੁੱਖ ਤੌਰ 'ਤੇ ਦੇਖਿਆ ਜਾਂਦਾ ਹੈ ਉੱਤਰਾਖੰਡ ਦੇ ਵਿੱਚ ਜੇ ਅਸੀਂ ਜਾਈਏ ਤਾਂ ਨੈਨੀਤਾਲ ਅਤੇ ਦੇਹਰਾਦੂਨ ਦੇ ਵਿੱਚ ਕਾਫੀ ਲੋਕ ਘੁੰਮਣ ਆਉਂਦੇ ਹਨ ਅਤੇ ਜੇ ਅਸੀਂ ਹਿਮਾਚਲ ਵੱਲ ਜਾਈਏ ਤਾਂ ਸ਼ਿਮਲੇ ਕੁੱਲੂ ਮਨਾਲੀ ਉਸ ਉੱਥੇ ਤਾਂ ਬਹੁਤ ਜ ਇਹੇ ਜਿਹੇ ਸਥਾਨ ਹਨ ਜਿੱਥੇ ਲੋਕ ਬਹੁਤ ਜ਼ਿਆਦਾ ਹੀ ਤਾਦਾਤ ਦੇ ਵਿਚ ਆਉਂਦੇ ਹਨ ਇੱਥੇ ਕਾਫੀ ਸਾਰੇ ਮੰਦਰ ਹਨ ਇਸ ਨੂੰ ਦੇਵ ਭੂਮੀ ਵੀ ਕਿਹਾ ਜਾਂਦਾ ਹੈ ਉਸ ਤੋਂ ਇਲਾਵਾ ਜੇ ਅਸੀਂ ਰੇਤ ਅਤੇ ਰੇਗਿਸਤਾਨ ਦੇਖਣੇ ਹਨ ਉਸ ਤੋਂ ਉਸ ਤੋਂ ਇਲਾਵਾ ਜੇ ਤੁਸੀਂ ਥੋੜ੍ਹਾ ਜਾ ਸਮੁੰਦਰੀ ਤੱਟ ਦੇਖਣਾ ਚਾਹੁੰਦੇ ਹਨ ਅਤੇ ਅਸੀਂ ਥੋੜ੍ਹਾ ਜਿਹਾ ਸਾਊਥ ਵੱਲ ਆ ਜਾਂਦੇ ਹਨ ਜੇ ਤੁਸੀਂ ਰਾਜਸਥਾਨ ਜਾਉਂਗੇ ਉੱਥੇ ਤੁਹਾਨੂੰ ਰੇਤ ਅਤੇ ਉੱਥੇ ਦਾ ਕਲਚਰ ਅਤੇ ਟਰੈਡੀਸ਼ਨ ਦੇਖਣ ਨੂੰ ਮਿਲੇਗਾ ਉੱਥੇ ਕਾਫੀ ਸਾਰੇ ਰੇਤੀਲੇ ਤੂਫ਼ਾਨ ਆਉਂਦੇ ਹਨ ਅਤੇ ਕੁਛ ਰੇਤ ਦੀ ਸਫਾਰੀਆਂ ਵੀ ਮੌਜੂਦ ਹਨ ਜੇ ਤੁਸੀਂ ਸਾਊਥ ਇੰਡੀਆ ਜਾਂਦੇ ਹੋ ਤਾਂ ਉੱਥੇ ਰਮੇਸ਼ਵਰਨ ਨਾਮ ਤੋਂ ਇੱਕ ਪ੍ਰਸਿੱਧ ਜਗ੍ਹਾ ਮੌਜੂਦ ਹੈ ਜਿੱਥੇ ਸ਼੍ਰੀ ਰਾਮ ਨੇ ਆਪਣੇ ਹੱਥਾਂ ਦੁਆਰਾ ਸ਼ਿਵਲਿੰਗ ਸਥਾਪਿਤ ਕੀਤਾ ਸੀ